ਹੈਲੋ ਹਾਂਜੀ ਜ ਸਤਿ ਸ਼੍ਰੀ ਆਕਾਲ ਜੀ ਹਾਂਜੀ ਦੱਸੋ ਹਾਂਜੀ ਅਸੀਂ ਕਰਵਾ ਸਕਦੇ ਹਾਂ ਤੁਸੀਂ ਤੁਸੀਂ ਦੱਸੋ ਤੁਹਾਨੂੰ ਕਿਸ ਟਾਈਪ ਰ ਰਿਅਨੋਵੇਸ਼ਨ ਕਰਵਾਉਣੀ ਹੈ ਠੀਕ ਹੈ ਠੀਕ ਠੀਕ ਹੈ ਜੀ ਅਸੀਂ ਤੁਹਾਨੂੰ ਹਾਂ ਕਿ ਤੁਹਾਨੂੰ ਭੇਜ ਦੇਵਾਂਗੇ ਆਪਣੇ ਅਸੀਂ ਤੁਹਾਨੂੰ ਫੋਟੋ ਦੇ ਜ਼ਰੀਏ ਭੇਜ ਦੇਵਾਂਗੇ ਅਸੀਂ ਜਿੰਨੇ ਵੀ ਵਧੀਆ ਵਧੀਆ ਡਿਜ਼ਾਇਨ ਹੋਏ ਤੁਸੀਂ ਦੱਸੋ ਪੂਰੇ ਘ ਕ ਕਮਰੇ ਨੂੰ ਡਿਜ਼ਾਇਨ ਕਰਨਾ ਕਿ ਪੂਰੇ ਘਰ ਨੂੰ ਹੀ ਠੀਕ ਹੈ ਫੇਰ ਤੁਸੀਂ ਦੱਸ ਦਿਉ ਸਾਨੂੰ ਕਿਸ ਤਰ੍ਹਾਂ ਦੇ ਡਿਜ਼ਾਇਨ ਚਾਹੀਦੇ ਆ ਤਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ ਫੇਰ ਠੀਕ ਹੈ

ਹਾਂਜੀ ਬ ਬਜਟ ਅਸੀਂ ਤੁਹਾਨੂੰ ਦੱਸ ਦੇਵਾਂਗੇ ਕਿਸ ਟ ਕਿੰਨਾ ਕਮਰਾ ਕਿੰਨਾ ਕੁ ਲੈਂਥ ਅਕੋਰਡਿੰਗ ਟੂ ਦੀ ਬਰੈਥ ਕਿਵੇਂ ਆ ਉਸ ਅਕੋਰਡਿੰਗ ਦੇਖ ਕੇ ਸਰ ਅਸੀਂ ਤੁਹਾਨੂੰ ਉਸ ਟਾਈਪ ਦੇ ਬਜਟ ਪ੍ਰੋਵਾਈਡ ਕਰਵਾ ਦੇਵਾਂਗੇ ਹਾਂਜੀ ਤੁਸੀਂ ਜਦੋਂ ਤੱਕ ਕਦੋਂ ਤੱਕ ਚਾਹੀਦੇ ਆ ਤੁਹਾਨੂੰ ਠੀਕ ਹੈ ਹਾਂਜੀ ਕਰ ਦੇਵਾਂਗੇ ਠੀਕ ਹੈ ਫੇਰ ਤੁਹਾਨੂੰ ਸਾਰੇ ਬਜਟ ਫੋਟੋਗ੍ਰਾਫ ਡਿਜ਼ਾਇਨ ਸਭ ਤੁਹਾਡੇ ਪਹੁੰਚਾ ਦੇਵਾਂਗੇ ਤੁਹਾਡੇ ਤੱਕ ਠੀਕ ਹੈ ਹੋਰ ਦੱਸੋ ਤੁਹਾਨੂੰ ਕ ਕੋਈ ਨਵੀਂ ਚੀਜ਼ ਇੰਨਕਲੂਡ ਕਰਨੀ ਹੋਵੇ ਵਿੱਚ ਤਾਂ ਉਹ ਵੀ ਦੱਸ ਦਿਓ ਠੀਕ ਹੈ ਠੀਕ ਹੈ ਜੀ ਉਸ ਨਾਲ ਰਿਲੈਟੇਡ ਸਾਰੇ ਡਿਜ਼ਾਇਨ ਤੁਹਾਨੂੰ ਅਸੀਂ ਫੋਟੋ ਕਰ ਦੇਵਾਂਗੇ ਅਤੇ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਦਿਓ ਲੋਕੇਸ਼ਨ ਸੈਂਡ ਕਰ ਦਿਓ ਕਿ ਤੁਸੀਂ ਕਿੱਥੇ ਕਰਵਾਉਣਾ ਅਸੀਂ ਤੁਹਾਨੂੰ ਸਾਰੀ ਇਨਫਰਮੇਸ਼ਨ ਕਰ ਦੇਵਾਂਗੇ ਅੱਗੇ ਫਾਰਵਰਡ ਠੀਕ ਹੈ ਓਕੇ ਥੈਂਕ